ਨੌ ਜਨਵਰੀ ਉੱਨੀ ਸੌ ਪੰਤਾਲੀ ਸੋਲਾਂ ਮਾਰਚ ਉਨੀ ਸੌ ਪਝੱਤਰ ਤੇਈ ਜੂਨ ਉੱਨੀ ਸੋ ਪਚਾਸੀ ਅਠਾਈ ਜੁਲਾਈ ਉਨੀ ਸੌ ਨੜਿਨਵੇਂ ਤੀਹ ਸਤੰਬਰ ਦੋ ਹਜ਼ਾਰ